ਸਾਨੂੰ ਆਵਾਜਾਈ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਹੁਣ ਤਾਂ ਨਾ ਦੇ ਬਰਾਬਰ ਹੀ ਕਰਨਾ ਪੈਂਦਾ ਹੈ ਜਦ ਕਿ ਪਹਿਲਾਂ ਬਹੁਤ ਕਰਨਾ ਪੈਂਦਾ ਸੀ ਕਿਉਂਕਿ ਸੜਕਾਂ ਜਦੋਂ ਖਰਾਬ ਸੀ ਅਤੇ ਹੁਣ ਸਰਕਾਰ ਨੇ ਸੜਕਾਂ ਹੀ ਬਹੁਤ ਵਧੀਆ ਬਣਾ ਦਿੱਤੀਆਂ ਨੇ ਅਤੇ ਸਾਨੂੰ ਪਹਿਲਾਂ ਚੰਡੀਗੜ੍ਹ ਜਾਣ ਲਈ ਤਕਰੀਬਨ ਡੇਢ ਘੰਟਾ ਲੱਗਦਾ ਸੀ ਜਦਕਿ ਹੁਣ ਅਸੀਂ ਪੌਣੇ ਘੰਟੇ ਵਿੱਚ ਪਹੁੰਚ ਜਾਂਦੇ ਹਾਂ ਅਤੇ ਆਵਾਜਾਈ ਦੀ ਵੀ ਕੋਈ ਘਾਟ ਨਹੀਂ ਹੈਗੀ ਅਰਾਮ ਨਾਲ ਸ ਬੱਸਾਂ ਟੈਕਸੀਆਂ ਅਰਾਮ ਨਾਲ ਮਿਲ ਜਾਂਦੀਆਂ ਨੇ ਅਤੇ ਕੋਈ ਇਹਦੇ ਵਿੱਚ ਦਿੱਕਤ ਨਹੀਂ ਆਉਂਦੀ ਅਤੇ ਸੜਕਾਂ ਬਹੁਤ ਵਧੀਆ ਨੇ ਅਤੇ ਬੰਦਾ ਨੋਰਮਲੀ ਕਿਤੇ ਵੀ ਕੋਈ ਵੀ ਟਰੈਵਲ ਕਰਨ ਵਿੱਚ ਕੋਈ ਪਰੋਬਲਮ ਨਹੀਂ ਆਉਂਦੀ ਹੁਣ